ਹਾਂਜੀ ਕਿਸੇ ਵੀ ਮੇਰੀ ਕਿਸੇ ਵੀ ਯਾਤਰਾ ਕਾਰਨ ਮੈਨੂੰ ਕਿਸੇ ਸੱਭਿਆਚਾਰ 'ਚ ਅਨੁਭਵ ਨਹੀਂ ਹੋਇਆ ਜੇ ਮੈਨੂੰ ਹੋਇਆ ਵੀ ਤਾਂ ਮੈਂ ਬਹੁਤ ਸੰਭਾਲ ਸਕਦੀ ਹਾਂ ਮੈਂ ਬਹੁਤ ਮਿੱਠਾ ਬੋਲਦੀ ਹਾਂ ਮੈਂ ਆਪਣੇ ਪਤੀ ਨੂੰ ਵੀ ਕਹਿ ਸਕਦੀ ਹਾਂ ਵੀ ਤੁਸੀਂ ਨਹੀਂ ਇੱਦਾਂ ਕਰਨਾ ਸਾਡੀ ਸੱਭਿਆਚਾਰਕ ਨਹੀਂ ਹੈਗਾ ਨਹੀਂ ਹੈਗਾ ਮੈਂ ਬੇਟੇ ਨੂੰ ਸਮਝਾ ਸਕਦੀ ਹਾਂ ਮੈਂ ਕੋਈ ਵੀ ਇੱਦਾਂ ਦਾ ਅਨੁਭਵ ਨਹੀਂ ਕਰੂੰਗੀ ਵੀ ਮੈਂ ਕਿੱਦਾਂ ਵੀ ਕਰਾਂ ਵੀ ਨਹੀਂ ਕਰਾਂ ਹਾਂਜੀ ਠੀਕ ਹੈ